ਪੰਜਾਬ ਦੁਆਰਾ ਦਰਪਦੇਸ਼ ਮੁੱਖ ਸੱਭਿਆਚਾਰਕ ਅਤੇ ਸਮਾਜਿਕ ਮੁੱਦੇ ਲੇ ਹਨ ਜਿੱਦਾਂ ਕੀ ਐਜੂਕੇਸ਼ਨ ਸਿਸਟਮ ਇੱਥੇ ਇੱਕੋ ਜਿਹਾ ਨਹੀਂ ਹੈਗਾ ਜਿੱਦਾਂ ਪ੍ਰਾਈਵੇਟ ਸੈਕਟਰ ਬਹੁਤ ਜ਼ਿਆਦਾ ਚਾਰਜ ਕਰਕੇ ਪੜ੍ਹਾਉਂਦਾ ਹੈ ਅਤੇ ਸਰਕਾਰੀ ਸੈਕਟਰ ਥੋੜ੍ਹੇ ਪੈਸੇ ਲੈਂਦਾ ਪਰ ਉੱਥੇ ਐਜੂਕੇਸ਼ਨ ਪ੍ਰੋਪਰ ਨਹੀਂ ਦਿੱਤੀ ਜਾਂਦੀ ਜਿਸ ਕਾਰਨ ਬੱਚਿਆਂ ਨੂੰ ਆਪਸ 'ਚ ਇਨਕ ਇਨਕੁਐਲਿਟੀ ਆਉਂਦੀ ਹੈ ਅਤੇ ਉਹ ਅੱਧੇ ਬੱਚੇ ਨਸ਼ਿਆਂ ਵੱਲ ਚਲੇ ਜਾਂਦੇ ਹਨ ਡਰੱਗਸ ਵੱਲ ਤੁਰ ਪੈਂਦੇ ਹਨ ਅਤੇ ਅੱਗੇ ਜਾ ਕੇ ਜਦੋਂ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਤਾਂ ਉਹ ਸੋਚਦੇ ਹਨ ਅਸੀਂ ਬਾਹਰਲੇ ਮੁਲਕਾਂ 'ਚ ਜਾ ਕੇ ਚਲੇ ਜਾਂਦੇ ਹਾਂ ਉੱਥੇ ਜਾ ਕੇ ਛੋਟੇ ਮੋਟੇ ਕੰਮ ਕਰ ਲਾਂਗੇ ਅਤੇ ਆਪਣੀ ਕਮਾਈ ਕਰਾਂਗੇ ਪਰ ਉੱਥੇ ਜਾ ਕੇ ਵੀ ਉਹ ਅਸਫਲ ਹੋ ਜਾਂਦੇ ਹਨ ਅਤੇ ਫਿਰ ਉਹ ਨਸ਼ਿਆਂ ਵੱਲ ਚੱਲ ਪੈਂਦੇ ਹਨ ਇਸਨੂੰ ਠੀਕ ਕਰਨ ਵਾਸਤੇ ਪੰਜਾਬ ਸਰਕਾਰ ਨੂੰ ਇੱਥੋਂ ਦੇ ਐਜੂਕੇਸ਼ਨ ਸਿਸਟਮ ਨੂੰ ਪਰੂਵ ਕਰਨਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਬੱਚਿਆਂ ਨੂੰ ਆਪਣੇ ਅੰਦਰ ਕੋਈ ਹੀਣਭਾਵਨਾ ਨਾ ਆਵੇ ਅਤੇ ਇੱਥੋਂ ਦੀ ਇਕੋਨਮੀ ਅਤੇ ਇੰਡਸਟਰੀ ਨੂੰ ਪਰੂਵ ਕਰਨਾ ਚਾਹੀਦਾ ਤਾਂ ਕਿ ਇੱਥੋਂ ਰੋਜ਼ਗਾਰ ਮਿਲੇ ਅਤੇ ਬਾਹਰ ਬੱਚੇ ਨਾ ਜਾਣ ਧੰਨਵਾਦ ਜੀ